ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਵੋਲਵੋ ਬਸ ਸਰਵਿਸ ਤੋਂ ਬੋਲ ਰਹੇ ਹੋ ਜੀ ਸਰ ਅਸੀਂ ਤੁਹਾਡੀ ਬੱਸ ਬੁੱਕ ਕਰਨੀ ਸੀ ਬਈ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਤੁਸੀਂ ਕਿਹੜੇ ਕਿਹੜੇ ਮੇਜਰ ਸਿਟੀਜ਼ ਪੰਜਾਬ ਦੇ ਕਿਹੜੇ ਕਿਹੜੇ ਮੇਜਰ ਸਿਟੀਜ਼ ਨੂੰ ਮਤਲਬ ਕੋਂਨੈਕਟ ਕਰ ਸਕਦੇ ਹੋ ਉੱਥੇ ਤੱਕ ਟਰੈਵਲ ਕਰ ਸਕਦੇ ਹੋ ਹਾਂਜੀ ਅੱਛਾ ਸਰ ਹੋਰ ਵੀ ਕੋਈ ਦਸ ਸਕਦੇ ਹੋ ਸਰ ਹੋਰ ਕਿੱਥੇ ਕਿੱਥੇ ਹੋ ਸਕਦੀ ਹੈ ਹਾਂਜੀ ਹੋ ਹੁਸ਼ਿਆਰਪੁਰ ਵੀ ਜਾ ਸਕਦੇ ਨਾ ਜੀ ਹਾਂਜੀ

ਅਸੀਂ ਔਫੀਸ਼ੀਅਲ ਟ੍ਰਿਪ ਨਹੀਂ ਹੈਗੀ ਜੀ ਮਤਲਬ ਕਹਿ ਲਓ ਵੀ ਜਿਵੇਂ ਗੁਆਂਢੀ ਇਕੱਠੇ ਹੋ ਕੇ ਜਾਂਦੇ ਹੁੰਦੇ ਆ ਓਦਾਂ ਨੋਰਮਲ ਜਾ ਰਹੇ ਹਾਂ ਨੇਬਰਜ਼ ਜਾ ਰਹੇ ਹਾਂ ਅਸੀਂ ਇਕੱਠੇ ਹੋ ਕੇ ਹਾਂਜੀ ਅਸੀਂ ਪਲੈਨ ਬਣਾ ਰਹੇ ਹਾਂ ਵੀ ਹੁਸ਼ਿਆਰਪੁਰ ਕੰਨੀ ਜਾਣ ਦਾ ਪਲੈਨ ਬਣਾ ਰਹੇ ਹਾਂ ਹਾਂਜੀ ਗੱਲ ਆ ਜੀ ਹੋਰ ਜਿਵੇਂ ਜੀ ਅੱਜ ਆਪਣੀ ਨਾਈਨਟੀਨ ਫੈਬ ਹੈ ਅਸੀਂ ਵਨ ਮਾਰਚ ਨੂੰ ਜਾਣਾ ਜੀ ਹਾਂਜੀ ਬਾਕੀ ਤੁਹਾਨੂੰ ਤੁਹਾਡੇ ਨਾਲ ਟਾਈਮਿੰਗ ਫਿਕਸ ਕਰ ਲਾਂਗੇ ਮਤਲਬ ਪ੍ਰੋਪਰ ਡੇਟ ਤੁਹਾਨੂੰ ਦੱਸ ਦਾਂਗੇ ਹਜੇ ਕੋਈ ਪੱਕਾ ਨਹੀਂ ਹੋਇਆ ਜੀ ਅਸੀਂ ਵਟੈਂਟੀ ਟੂ ਟਵੈਂਟੀ ਫਾਈਵ ਮੈਕਸੀਮਮ ਟਵੈਂਟੀ ਫਾਈਵ

ਮਤਲਬ ਤੁਸੀਂ ਕਿੰਨੇ ਕਿੰਨੇ 'ਚ ਲਿਜਾ ਸਕਦੇ ਹੋ ਹਾਂਜੀ ਸਰ ਬਾਈ ਕੁ ਸੌ ਦੇ ਵਿੱਚ ਸਾਰੇ ਫੈਸਲਿਟੀਜ਼ ਆ ਨਹੀਂ ਸਕਦੀਆਂ ਏ ਸੀ ਵਗੈਰਾ ਵਗੈਰਾ ਜੀ ਜਾਂ ਥੋੜ੍ਹਾ ਬਹੁਤਾ ਜਾਂ ਥੋੜ੍ਹਾ ਬਹੁਤਾ ਚਲ ਜੂ ਮਤਲਬ ਆਪਾਂ ਛੱਬੀ ਸੌ ਕੁ ਦੇ ਤੱਕ ਅਫੋਡ ਕਰ ਸਕਦੇ ਹਾਂ

ਚਲੋ ਤੁਸੀਂ ਮਿਨੀਮਮ ਤੋਂ ਮੈਨੂੰ ਪਰ ਪਰਸਨ ਕਿੰਨਾ ਕਰ ਸਕਦੇ ਹੈ

ਹਾਂਜੀ ਸਰ ਫਿਰ ਤਾਂ ਮੈਂ ਠੀਕ ਹਾਂ ਮਤਲਬ ਰਸਤੇ 'ਚ ਜੇ ਕਿਤੇ ਕਿਸੇ ਨੇ ਰੁਕਣਾ ਹੋਵੇ ਥੋੜ੍ਹਾ ਟਾਈਮ ਲਈ ਉਹ ਵੀ ਸਰਵਿਸ ਸਾਨੂੰ ਮਿਲ ਸਕਦੀ ਆ ਜੀ ਹਾਂਜੀ ਮਤਲਬ ਤੁਹਾਡੇ ਨਾਲ ਫਿਰ ਮੈਂ ਟਾਈਮਿੰਗ ਅਤੇ ਡੇਟ ਫਿਕਸ ਕਰ ਲਉਂਗਾ ਜੀ ਉਹਦੇ ਕੋਲ ਮਤਲਬ ਅਸੀਂ ਪਹਿਲਾਂ ਆਪਣੀ ਮੀਟਿੰਗ ਇੱਕ ਰੱਖੀ ਆ ਉਹ ਅਟੈਂਡ ਕਰ ਲਈਏ ਫਿਰ ਉਸ ਉਸ ਤੋਂ ਬਾਅਦ ਮਤਲਬ ਤੁਹਾਡੇ ਨਾਲ ਟਾਈਮਿੰਗ ਅ ਸੈਟ ਬੈਠ ਜੂਗੀ ਫਿਰ ਤੁਹਾਡੇ ਨਾਲ ਗੱਲ ਕਰ ਲਾਂਗੇ ਜੀ ਹਾਂਜੀ ਚਲੋ ਥੈਂਕ ਯੂ ਜੀ